ਮੇਰੀ ਬਚਪਨ ਦੀ ਯਾਤਰਾ ਮੇਰੀ ਉਮਰ ਤਕਰੀਬਨ ਤਕਰੀਬਨ ਦਸ ਬਾਰ੍ਹਾਂ ਕੁ ਸਾਲ ਸੀ ਜਦੋਂ ਅਸੀਂ ਅਨੰਦਪੁਰ ਸਾਹਿਬ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਮੱਥਾ ਟੇਕਿਆ ਉੱਥੇ ਲੰਗਰ ਦੇ ਵਿੱਚ ਪ੍ਰਸ਼ਾਦਾ ਪਾਣੀ ਵੀ ਛਕਿਆ ਕੜਾਹ ਪ੍ਰਸ਼ਾਦ ਹੋਰ ਵੀ ਅਤੇ ਉਸ ਤੋਂ ਬਾਅਦ ਮਾਤਾ ਦੇ ਨੈਣਾਂ ਦੇਵੀ ਮੱਥਾ ਟੇਕਿਆ ਉਥੇ ਰਸਤੇ ਦੇ ਵਿੱਚ ਪਹਾੜ ਦੇਖੇ ਜਿਹੜਾ ਕਿ ਵਾਤਾਵਰਨ ਦਾ ਬਹੁਤ ਵਧੀਆ ਅਦਭੁਤ ਨਜ਼ਾਰਾ ਸੀ ਉਥੇ ਹੋਰ ਤਰ੍ਹਾਂ ਦੇ ਜਾਨਵਰ ਪੰਛੀ ਅਤੇ ਵੱਖ ਵੱਖ ਤਰ੍ਹਾਂ ਦੇ ਦਰੱਖਤ ਵੀ ਦੇਖੇ ਵੱਖ ਵੱਖ ਤਰਾਂ ਦੇ ਫੁੱਲ ਫਲ਼ ਵੀ ਦੇਖੇ ਰਸਤੇ ਦੇ ਵਿਚ ਆਉਂਦੇ ਹੋਏ ਨਵੇਂ ਨਵੇਂ ਤਰੀਕੇ ਦੀਆਂ ਬੱਸਾਂ ਗੱਡੀਆਂ ਵੀ ਦੇਖੀਆਂ ਹੋਰ ਵੀ ਬਹੁਤ ਜ਼ਿਆਦਾ ਚੀਜ਼ਾਂ ਦੇਖਣ ਨੂੰ ਮਿਲੀਆਂ